ਹਾਂ ਮੈਂ ਆਪਣੇ ਕੈਮਰੇ ਦੀ ਵਰਤੋਂ ਕਰਦੇ ਹੋਏ ਰੀਲਾਂ ਜਾਂ ਸ਼ੋਰਟਸ ਵੀ ਸ਼ੂਟ ਕਰਦਾ ਹਾਂ ਸ਼ੋਰਟਸ ਸ਼ੂਟ ਕਰਨ ਸਮੇਂ ਮੈਂ ਕੋਈ ਜਗ੍ਹਾ ਖਾਸ ਜਗ੍ਹਾ ਨਹੀਂ ਚਾਹੀਦੀ ਮੈਨੂੰ ਜਿੱਥੇ ਵੀ ਕੋਈ ਵਧੀਆ ਵੀਡੀਓ ਜਾਂ ਕੋਈ ਅਜਿਹੀ ਕਿਸੇ ਵੀ ਪ੍ਰਕਾਰ ਦੀ ਸੇਧ ਜਾਂ ਕੋਈ ਮੇਰੇ ਆਪਣੀ ਜ਼ਿੰਦਗੀ ਰੀਅਲ ਲਾਈਫ ਨਾਲ ਜੁੜਦੀ ਕੋਈ ਸੱਚੀ ਘਟਨਾ ਮਿਲਦੀ ਹੈ ਤਾਂ ਮੈਂ ਉਸਨੂੰ ਸੂਟ ਕਰ ਲੈਨਾ ਤੇ ਬਾਅਦ ਵਿੱਚ ਉਸਨੂੰ ਹੋਰ ਵਧੀਆ ਢੰਗ ਨਾਲ ਪੇਸ਼ਕਾਰ ਪੇਸ਼ਕਾਰੀ ਕਰਕੇ ਤੇ ਆਪਣੇ ਯੂਟੀਊਬ ਚੈਨਲ ਉਪਰ ਵੀ ਅਪਲੋਡ ਕਰ ਦਿੰਨਾ ਹਾਂ ਤੇ ਦਰਸ਼ਕਾਂ ਵੱਲੋਂ ਵੀ ਮੈਨੂੰ ਬਹੁਤ ਸਾਰਾ ਸਤਿਕਾਰ ਤੇ ਪਿਆਰ ਬਖਸ਼ਿਆ ਜਾਂਦਾ ਤੇ ਨਾਲ ਹੀ ਉਹਨਾਂ ਵੀਡੀਓ ਨੂੰ ਮੈਂ ਸਾਂਭ ਕੇ ਰੱਖ ਲੈਂਦਾ ਹਾਂ ਤੇ ਨਾਲ ਹੀ ਉਹ ਮੈਂ ਵੀਡੀਓ ਹੋਰ ਦਰਸ਼ਕਾਂ ਨੂੰ ਵੀ ਸੈਂਡ ਕਰ ਦਿੰਦਾ ਹਾਂ